ਲੋਕਾਂ ਨੇ ਮੱਝਾਂ ਗਾਵਾਂ ਬੱਕਰੀਆਂ ਆਦਿ ਰੱਖੀਆਂ ਹੋਈਆਂ ਹਨ ਅਤੇ ਅਸਾਂ ਵੀ ਇੱਕ ਗਾਂ ਰੱਖੀ ਹੈ ਅਤੇ ਸਾਡੇ ਗੁਆਂਡੀਆਂ ਨੇ ਵੀ ਦੋ ਤਿੰਨ ਗਾਵਾਂ ਰੱਖੀਆਂ ਹਨ ਅਤੇ ਡੇਅਰੀ ਫਾਰਮ ਦਾ ਕੰਮ ਕਰਦੇ ਹਨ ਅਤੇ ਉਹਨਾਂ ਨੇ ਮੱਝਾਂ ਵੀ ਰੱਖੀਆਂ ਹੋਈਆਂ ਹਨ ਮੱਝਾ ਦੇ ਦੁੱਧ ਅਤੇ ਗਾਂ ਦੇ ਦੁੱਧ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈ ਤਾਂ ਮੱਝਾਂ ਦਾ ਦੁੱਧ ਸੰਘਣਾ ਹੁੰਦਾ ਹੈ ਅਤੇ ਗਾਵਾਂ ਦਾ ਦੁੱਧ ਬਹੁਤ ਹੀ ਪਤਲਾ ਹੁੰਦਾ ਹੈ ਤਾਂ ਮੱਝਾਂ ਦੇ ਦੁੱਧ ਤੋਂ ਦਹੀ ਤੋਂ ਮੱਖਣ ਵੀ ਬਹੁਤ ਜ਼ਿਆਦਾ ਨਿਕਲਦਾ ਹੈ ਅਤੇ ਗਾਈਂ ਦੇ ਦੁੱਧ ਤੋਂ ਮੱਖਣ ਬੜਾ ਜ਼ਿਆਦਾ ਘੱਟ ਨਿਕਲਦਾ ਹੈ ਅਤੇ ਮੱਝਾਂ ਦਾ ਦੁੱਧ ਪੋਸ਼ਟਿਕ ਵੀ ਹੁੰਦਾ ਹੈ ਅਤੇ ਗਾਵਾਂ ਦਾ ਉਸ ਤੋਂ ਵੀ ਜ਼ਿਆਦਾ ਪੋਸ਼ਟਿਕ ਹੁੰਦਾ ਹੈ ਅਤੇ ਬੱਕਰੀਆਂ ਦਾ ਦੁੱਧ ਉਧਰ ਉਸ ਤੋਂ ਕਿਤੇ ਜ਼ਿਆਦਾ ਵੱਧ ਕੇ ਪੋਸ਼ਟਿਕ ਹੁੰਦਾ ਹੈ ਬੱਕਰੀ ਦਾ ਦੁੱਧ ਬੜਾ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਵਿਟਾਮਿਨਾਂ ਨਾਲ ਪ੍ਰੋਟੀਨ ਆਦਿ ਨਾਲ ਭਰਿਆ ਹੁੰਦਾ ਹੈ ਪੋਸ਼ਟਿਕ ਹੁੰਦਾ ਹੈ ਗਾਵਾਂ ਦਾ ਦੁੱਧ ਵੀ ਬਹੁਤ ਹੀ ਵਧੀਆ ਹੁੰਦਾ ਹੈ ਸਿਹਤ ਲਈ ਚੰਗਾ ਹੁੰਦਾ ਹੈ